ਮੈਂ ਜੀ ਅਲੀ ਬਾਬਾ ਕੰਪਨੀ ਤੋਂ ਇੱਕ ਪ੍ਰਿੰਟਰ ਮੰਗਾਇਆ ਸੀਗਾ ਇਹ ਔਨਲਾਈਨ ਕੰਪਨੀ ਹੈਗੀ ਹੈ ਅਤੇ ਇਹ ਤਾਂ ਮੈਂ ਔਡਰ ਕੀਤਾ ਸੀਗਾ ਅਤੇ ਮੈਨੂੰ ਬਹੁਤ ਲੋੜ ਸੀਗੀ ਪ੍ਰਿੰਟਰ ਦੀ ਅਤੇ ਮੈਂ ਥੋੜ੍ਹਾ ਕੋਸਟਲੀ ਖਰੀਦਿਆ ਉਹ ਅਤੇ ਜਦੋਂ ਉਹ ਮੈਨੂੰ ਡਿਲੀਵਰ ਹੋਇਆ ਤਾਂ ਉਹਦੀ ਪੈਕਿੰਗ ਬਹੁਤ ਗਲਤ ਢੰਗ ਨਾਲ਼ ਕੀਤੀ ਸੀਗੀ ਥਾਂ ਥਾਂ 'ਤੇ ਟੇਪਾਂ ਲਗਾਈਆਂ ਹੋਈਆਂ ਸੀਗੀਆਂ ਅਤੇ ਹੋਰ ਅਨਪੈਕਿੰਗ ਕਰਦੇ ਕਰਦੇ ਥੋੜ੍ਹੇ ਜਿਹੇ ਕਰੈਕ ਆ ਗਏ ਅਤੇ ਜਦੋਂ ਮੈਂ ਚਲਾ ਕੇ ਦੇਖਿਆ ਤਾਂ ਉਹ ਚੱਲਿਆ ਵੀ ਹੈ ਨਹੀਂ ਉਹ ਫਿਰ ਮੈਂ ਜਦੋਂ ਉਹਦੇ ਕਸਟਮਰ ਕੇਅਰ ਨਾਲ਼ ਗੱਲ ਕੀਤੀ ਤਾਂ ਉਹਨਾਂ ਨੇ ਵੀ ਕੋਈ ਬਹੁਤਾ ਵਧੀਆ ਜਵਾਬ ਨਹੀਂ ਦਿੱਤਾ ਅਤੇ ਉਸ ਤੋਂ ਬਾਅਦ ਮੈਨੂੰ ਲੋੜ ਸੀਗੀ ਅਤੇ ਮੈਂ ਲੋਕਲ ਰਿਪੇ ਮਕੈਨਿਕ ਨੂੰ ਦਿਖਾਇਆ ਤਾਂ ਉਸ ਤੋਂ ਵੀ ਉਹ ਹੱਲ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਇਹਦੇ 'ਚ ਫਲਾਣੀ ਚੀਜ਼ ਪੈਣੀ ਹੈ ਉਹਦੇ ਪੈਸੇ ਲੱਗਣਗੇ ਤਾਂ ਕੁੱਲ ਮਿਲਾ ਕੇ ਮੇਰਾ ਤਜ਼ਰਬਾ ਇਹ ਬਹੁਤ ਮਾੜਾ ਰਿਹਾ ਅਤੇ ਇਸ ਲਈ ਮੈਂ ਤੁਹਾਨੂੰ ਹਮੇਸ਼ਾ ਸਭ ਨੂੰ ਕਹਿੰਦਾ ਕਿ ਕਿਸੇ ਵਧੀਆ ਕੰਪਨੀ ਦਾ ਹੀ ਪ੍ਰਿੰਟਰ ਖਰੀਦੋ ਅਤੇ ਵਧੀਆ ਵੈਬਸਾਈਟ ਤੋਂ ਹੀ ਖਰੀਦੋ ਅਤੇ ਜਿਹਦੇ ਨਾਲ਼ ਤੁਹਾਨੂੰ ਆਫਟਰ ਕੋਈ ਗਰੰਟੀ ਵਰੰਟੀ ਮਿਲ਼ ਸਕੇ